ਭਾਰਤ ਵਿੱਚ ਬਹੁਤ ਸਾਰੀਆਂ ਸੱਭਿਆਚਾਰਕ ਪਰੰਪਰਾਵਾਂ ਹਨ ਜਿਵੇਂ ਕਿ ਅਸੀਂ ਪੰਜਾਬ ਨੂੰ ਹੀ ਮੱਦੇਨਜ਼ਰ ਰੱਖਦੇ ਦੇਖੀਏ ਤਾਂ ਪੰਜਾਬ ਵਿੱਚ ਬਹੁਤ ਸਾਰੇ ਤਿਉਹਾਰ ਹੈ ਜੋ ਧੂਮਧਾਮ ਨਾਲ ਮਨਾਏ ਜਾਂਦੇ ਹਨ ਅਤੇ ਬਹੁਤ ਹੀ ਸੱਭਿਆਚਾਰਕ ਪਰੰਪਰਾਵਾਂ ਹਨ ਜਿਨ੍ਹਾਂ ਵਿੱਚ ਲੋਕ ਬਹੁਤ ਜ਼ਿਆਦਾ ਵਿਸ਼ਵਾਸ ਕਰਦੇ ਹਨ ਜਿਵੇਂ ਪੰਜਾਬੀ ਆਮ ਤੌਰ 'ਤੇ ਵਿਸਾਖੀ ਬਹੁਤ ਜ਼ਿਆਦਾ ਧੂਮਧਾਮ ਨਾਲ ਮਨਾਉਂਦੇ ਹਨ ਕਿਉਂਕਿ ਖਾਲਸੇ ਦਾ ਤਿਉਹਾਰ ਹੈ ਜੋ ਬਹੁਤ ਜ਼ਿਆਦਾ ਧੂਮਧਾਮ ਨਾਲ ਹਰ ਇੱਕ ਜਗ੍ਹਾ ਹਰ ਇੱਕ ਪਿੰਡ ਕਸਬੇ ਛੋਟੇ ਤੋਂ ਛੋਟੇ ਵਿੱਚ ਮਨਾਇਆ ਜਾਂਦਾ ਹੈ ਜਿਵੇਂ ਪੰਜਾਬੀ ਮੁਟਿਆਰਾਂ ਗਿੱਧਾ ਜਾਗੋ ਲੁੱਡੀ ਆਦਿ ਖੇਡਦੀਆਂ ਹਨ ਅਤੇ ਬਹੁਤ ਮਨਾ ਆਨੰਦ ਮਾਣਦੀਆਂ ਹਨ ਸਾਉਣ ਦੇ ਮਹੀਨੇ ਵਿੱਚ ਪੀਂਘਾਂ ਪਾ ਕੇ ਪੀਂਘਾਂ ਝੂਟਦੀਆਂ ਹਨ ਪੰਜਾਬਣਾਂ ਹੋਰ ਵੀ ਬਹੁਤ ਸਾਰੀਆਂ ਕਿਰਿਆਵਾਂ ਹਨ ਜੋ ਪੰਜਾਬ ਵਿੱਚ ਕੀਤੀਆਂ ਜਾਂਦੀਆਂ ਹਨ ਇਸ ਤਰ੍ਹਾਂ ਹੀ ਜੇ ਅਸੀਂ ਹੋਰ ਭਾਰਤ ਦੇ ਕਿਸੇ ਹਿੱਸੇ ਦੀ ਗੱਲ ਕਰੀਏ ਤਾਂ ਹੋਰ ਸਭ ਵੀ ਬਹੁਤ ਤਿਉਹਾਰ ਹੈ ਜੋ ਧੂਮਧਾਮ ਨਾਲ ਮਨਾਏ ਜਾਂਦੇ ਹਨ ਜਿਵੇਂ ਕਿ ਗੁਜਰਾਤ ਵਿੱਚ ਗੁਜਰਾਤੀ ਭਾਸ਼ਾ ਬੋਲੀ ਜਾਂਦੀ ਹੈ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ